ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ ਜਾਂਚ ਹੈ ਜਿਸ ਵਿੱਚ ਉਹਨਾਂ ਲੋਕਾਂ ਦਾ ਰਹਿਣ ਸਹਿਣ ਕਿੱਤੇ ਰਸਮ ਰਿਵਾਜ ਰਿਸ਼ਤੇ ਨਾਤੇ ਪਹਿਰਾਵਾ ਵਿਸ਼ਵਾਸ ਕੀਮਤਾਂ ਮਨੋਰੰਜਨ ਦੇ ਸਾਧਨ ਭਾਸ਼ਾ ਅਤੇ ਲੋਕ ਸਾਹਿਤ ਸ਼ਾਮਿਲ ਹੁੰਦੇ ਹਨ ਓਪਰੀ ਨਜ਼ਰੇ ਵੇਖਿਆ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ ਉੱਥੇ ਇੱਦਾਂ ਦੀ ਇੱਦਾਂ ਦਾ ਅਧਿਐਨ ਕਰਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਜਟਲ ਵਰਤਾਰਾ ਹੈ ਅਸਲ ਵਿੱਚ ਕੋਈ ਵੀ ਕੌਮਾਂ ਜਾਂ ਕੋਈ ਵੀ ਜਨ ਸਮੂਹ ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਸੱਭਿਆਚਾਰ ਤੋਂ ਸੱਖਣਾ ਨਹੀਂ ਹੁੰਦਾ ਭਾਵੇਂ ਉਹ ਵਿਕਾਸ ਦੇ ਕਿਸੇ ਵੀ ਪੜਾਅ ਉੱਤੇ ਕਿਉਂ ਨਾ ਹੋਵੇ ਸਮਾਜ ਵਿੱਚ ਰਹਿਣਾ ਹੀ ਸਮਾਜਿਕ ਜੀਵਨ ਹੈ